ਗਾਇਨ ਵਿੱਚ ਸਾਹ ਨੂੰ ਨਿਯੰਤਰਣ ਕਰਨ ਲਈ ਇੱਕ ਚੰਗੇ ਗੁਰੂ ਦੀ ਸਿੱਖਿਆ ਅਤੇ ਰੋਜ਼ਾਨਾ ਦਾ ਅਭਿਆਸ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਗਾਇਨ ਕਰਨ ਸਮੇਂ ਉਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆ ਸਕੇ ਗਾਇਨ ਨੂੰ ਰੋਜ਼ਾਨਾ ਮੈਂ ਦੋ ਤੋਂ ਤਿੰਨ ਘੰਟੇ ਦਿੰਦੀ ਹਾਂ ਤਾਂ ਜੋ ਮੈਂ ਆਪਣੇ ਗਾਇਨ ਵਿੱਚ ਆਪਣੇ ਸਾਹ ਨੂੰ ਨਿਯੰਤਰਣ ਰੱਖ ਸਕਾਂ ਅਤੇ ਸੁਰ ਅਤੇ ਤਾਲ ਨੂੰ ਸਹੀ ਜਗ੍ਹਾ ਅਤੇ ਸਹੀ ਟਾਈਮ 'ਤੇ ਲਗਾ ਸਕਾਂ ਇਸ ਨਾਲ ਮੇਰੇ ਗਾਇਨ ਵਿੱਚ ਬਹੁਤ ਸੁਧਾਰ ਆਇਆ ਹੈ